ਹਾਂਜੀ ਹਾਂਜੀ ਹਾਂਜੀ ਬੋਲੋ ਅੱਛਾ ਜੀ ਹਾਂਜੀ ਹਾਂਜੀ ਮੈਂ ਨਵਾਂ ਸ਼ਹਿਰ ਤੋਂ ਬੋਲ ਰਿਹਾ ਬਹੁਤ ਜਗ੍ਹਾ ਹੈ ਜੀ ਇੱਥੇ ਘੁੰਮਣ ਲਈ ਬਹੁਤ ਹੈ ਇੱਥੇ ਸ਼ਹੀਦਾਂ ਦਾ ਹੈਗਾ ਹੈ ਸ਼ਹੀਦ ਭਗਤ ਸਿੰਘ ਜੀ ਦਾ ਘਰ ਹੈ ਦੇਖਣ ਆਲਾ ਠੀਕ ਐ ਜੀ ਬਿਲਕੁੱਲ ਜੀ ਫਿਕਰ ਨਾ ਕਰੋ ਬਹੁਤ ਜਗ੍ਹਾ ਹੈ ਇੱਥੇ ਨਵਾਂ ਸ਼ਹਿਰ 'ਚ ਘੁੰਮਣ ਵਾਲੀਆ ਸਾਰੀਆਂ ਦਿਖਾ ਦਵਾਂਗਾ ਤੁਹਾਨੂੰ ਇੱਕ ਤਾਂ ਖਟਕੜ ਕਲਾ ਹੈ ਸਾਡੇ ਜਿੱਥੇ ਸ਼ਹੀਦਾਂ ਦੇ ਸਾਡੇ ਸ਼ਹੀਦ ਭਗਤ ਸਿੰਘ ਜੀ ਦਾ ਘਰ ਹੈ ਫਿਰ ਇੱਥੇ ਕਈ ਗੁਰਦੁਆਰਾ ਸਾਹਿਬ ਨੇ ਨਾਨਕਸਰ ਗੁਰਦੁਆਰਾ ਹੈ ਫਿਰ ਸਾਡੇ ਇੱਥੇ ਕਈ ਰੈਸਟ ਟ੍ਰਡੀਸ਼ਨਲ ਉਹ ਵੀ ਹੈ ਰੈਸਟੋਰੈਂਟ ਐ ਜਿੱਥੇ ਕਿ ਟ੍ਰਡੀਸ਼ਨਲ ਰੋਟੀ ਵਗੈਰਾ ਮਿਲਦੀ ਹੈ ਬਹੁਤ ਜਗ੍ਹਾ ਹੈ ਜੀ ਘੁੰਮਣ ਆਲੀ ਤੁਸੀਂ ਜਦ ਆਉਣਾ ਹੋਇਆ ਦੱਸ ਦਿਓ ਅਸੀਂ ਘੁੰਮਾ ਦਵਾਂਗੇ ਕਦੋ ਆਉਣਾ ਤੁਸੀਂ ਕੋਈ ਨੀ ਮੈਨੂੰ ਡੇਟ ਦੱਸ ਦਿਓ ਕਿਹੜੀ ਡੇਟ ਨੂੰ ਆਉਣਾ ਤੁਸੀਂ ਬਸ ਠੀਕ ਹੈ ਜੀ ਤੁਸੀਂ ਬਸ ਦੋ ਦਿਨ ਪਹਿਲਾਂ ਮੈਨੂੰ ਰੀਮਾਈਡਰ ਦੇ ਦਿਓ ਚੌਦਾਂ ਤਰੀਕ ਨੂੰ ਮੈਨੂੰ ਦੱਸ ਦਿਓ ਅੱਬਲ ਤਾਂ ਦਸੰਬਰ 'ਚ ਅਸੀਂ ਵਿਹਲੇ ਹੀ ਹੁੰਦੇ ਹਾਂ ਇੰਨਾਂ ਕੁ ਉਹ ਨਹੀਂ ਹੁੰਦਾ ਕੋਈ ਨੀ ਹੋਟਲ ਕੋਈ ਨੀ ਮੈਂ ਕਰਾਂਦੂਗਾ ਦੱਸ ਦਿਓ ਮੈਨੂੰ ਕਿੰਨੇ ਪਰਸਨ ਹੈ ਅਤੇ ਅੱਬਲ ਮੈਂ ਤੁਹਾਨੂੰ ਉਹਦਾ ਹੋਟਲ ਵਾਲਿਆ ਦਾ ਹੀ ਨੰਬਰ ਦੇ ਦਵਾਂਗਾ ਤੁਸੀਂ ਡਾਈਰੇਕਟ ਉਹਨਾਂ ਨਾਲ਼ ਹੀ ਗੱਲ ਕਰ ਲਿਓ ਠੀਕ ਹੈ ਉੱਥੇ ਬੁਕਿੰਗ ਕਰਾਂ ਲਿਓ ਉਹਨਾਂ ਨੇ ਬੁੱਕ ਕਰ ਲੈਣਾ ਨਾਮ ਲੈ ਦਿਓ ਚਾਹੇ ਮੇਰਾ ਕਿ ਉਹਨਾਂ ਨੇ ਨੰਬਰ ਦਿੱਤਾ ਸੀ ਗਲੈਕਸੀ ਹੋਟਲ ਹੈ ਜੀ ਉੱਥੇ ਬਹੁ ਵਧੀਆ ਹੋਟਲ ਹੈ ਪਰਿਵਾਰਿਕ ਹੈ ਪੂਰਾ ਠੀਕ ਹੈ ਜੀ ਓਕੇ ਜੀ ਹਾਂਜੀ ਹਾਂਜੀ ਕੋਈ ਨੀ ਮੈਨੂੰ ਕੋਲ ਕਰ ਲਿਓ ਆ ਕੇ ਠੀਕ ਹੈ ਓਕੇ ਜੀ ਬਾਏ